ਹਾਂਜੀ ਬਿਲਕੁਲ ਪਿੰਡਾਂ ਨੂੰ ਤਰਜੀਹ ਦੇਵਾਂਗੇ ਕਿਉਂਕਿ ਪਿੰਡਾਂ ਦਾ ਵਾਤਾਵਰਨ ਜੋ ਵਧੀਆ ਹੁੰਦਾ ਓੱਥੋਂ ਦੇ ਜਿਹੜੇ ਭਾਈਚਾਰਾ ਉਹ ਵੀ ਵਧੀਆ ਹੁੰਦਾ ਹੈ ਦੇਖੋ ਆਪਾਂ ਦੇਖ ਰਹੇ ਹਾਂ ਜਿਵੇਂ ਹੁਣ ਪਿੰਡਾਂ ਵਿੱਚ ਕੋਈ ਮੰਨ ਲਓ ਕਿਸੇ ਦੇ ਵਿਆਹ ਸ਼ਾਦੀ ਆ ਤਾਂ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਆਪਸ 'ਚ ਮਿਲ ਕੇ ਕੰਮ ਕਰਦੇ ਨੇ ਸਾਰੇ ਮਿਲਦੇ ਨੇ ਆਂਉਦੇ ਨੇ ਮਿਲਦੇ ਨੇ ਭੈਣ ਭਾਈ ਨੂੰ ਮਿਲਦੇ ਨੇ ਸਾਰੇ ਕੰਮ ਮੰਨ ਲਓ ਘਰਦਿਆਂ ਨੂੰ ਨਹੀਂ ਇੰਨੀ ਫਿਕਰ ਹੁੰਦੀ ਜਿੰਨੀ ਉਹ ਪਿੰਡ ਵਾਸੀਆਂ ਨੂੰ ਹੁੰਦੀ ਆ ਉਹ ਸਾਰੇ ਮਿਲ ਕੇ ਕੰਮ ਕਰਦੇ ਨੇ ਸਾਰੇ ਭਾਂਡਾ ਠੀਕਰ ਜੋ ਵੀ ਹੁੰਦਾ ਉਹ ਲਿਆਉਂਦੇ ਨੇ ਬਾਕੀ ਪਿੰਡਾਂ ਵਿੱਚ ਹੋਰ ਹੈ ਪਿੰਡਾਂ ਦਾ ਵਾਤਾਵਰਨ ਸਾਫ਼ ਹੈ ਇੱਥੇ ਲੋਕਾਂ ਨੂੰ ਕੋਈ ਪ੍ਰਦੂਸ਼ਣ ਦਾ ਨਹੀਂ ਕੋਈ ਐਂ ਨਹੀਂ ਵੀ ਸਾਡੇ ਘਰ ਕੋਈ ਹੋਰ ਉਹ ਐਰਾ ਵਗੈਰਾ ਵੜ੍ਹ ਜੂਗਾ ਉਨ੍ਹਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਕੀ ਸਾਡੇ ਘਰਾਂ ਦਾ ਮਹੌਲ ਹੈ ਪਿੰਡਾਂ ਵਿੱਚ ਆਪਾਂ ਮੇਨ ਗੱਲ ਕਰੀਏ ਸਬਜ਼ੀਆਂ ਭਾਜ਼ੀਆਂ ਤਾਜੀਆਂ ਮਿਲਦੀਆਂ ਨੇ ਕਿਉਂਕਿ ਖੇਤਾਂ ਵਿੱਚ ਲੱਗੀਆਂ ਹੁੰਦੀਆਂ ਲੋਕ ਖੇਤਾਂ ਵਿੱਚੋਂ ਤੋੜ ਲਿਆਉਂਦੇ ਹੈ ਦੁੱਧ ਵਾਧ ਦੀ ਕੋਈ ਘਾਟ ਨਹੀਂ ਹੁੰਦੀ ਲੱਕੜ ਬਾਲਣ ਵਾਧੂ ਮਿਲਦਾ ਪਿੰਡਾਂ ਵਿੱਚ ਕਿਉਂਕਿ ਪਿੰਡਾਂ ਵਿੱਚ ਪਸ਼ੂ ਰੱਖੇ ਜਾਂਦੇ ਨੇ ਉਨ੍ਹਾਂ ਤੋਂ ਆਪਾਂ ਨੂੰ ਵਧੀਆ ਦੁੱਧ ਤਾਜਾ ਹਰ ਟੈਮ ਕਦੋਂ ਮਰਜੀ ਲੈ ਕੇ ਆਓ ਅਤੇ ਗ ਗੱਲ ਕਰੀਏ ਤਾਂ ਸ਼ਹਿਰਾਂ ਦੀ ਸ਼ਹਿਰਾਂ ਵਿੱਚ ਤਾਂ ਪ੍ਰਦੂਸ਼ਣ ਹੀ ਬਹੁਤ ਹੈ ਇੰਨਾ ਪ੍ਰਦੂਸ਼ਣ ਹੈ ਕਿ ਦੇਖੋ ਸ਼ਹਿਰਾਂ ਵਿੱਚ ਲੋਕ ਰਹਿ ਰਹੇ ਨੇ ਤਾਂ ਉਨ੍ਹਾਂ ਨੂੰ ਸਾਹ ਦੀਆਂ ਬੀਮਾਰੀਆਂ ਹੁੰਦੀਆਂ ਨੇ ਅਤੇ ਜ ਹੋਰ ਦੇਖੀਏ ਗੰਦ ਮੰਦ ਬਹੁਤ ਹੈ ਪੈ ਰਿਹਾ ਗਾ ਥਾਂ ਥਾਂ 'ਤੇ ਦੇਖੋ ਲੋਕ ਕਿਵੇਂ ਗੰਦ ਪਾਉਂਦੇ ਨੇ ਅਤੇ ਸ਼ਹਿਰਾਂ ਵਿੱਚ ਇਹ ਸਭ ਤੋਂ ਮੈਂ ਇੱਕ ਗੱਲ ਦੇਖੀ ਹੈ ਵੀ ਸ਼ਹਿਰਾਂ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਹੈ ਜਿੱਥੇ ਕਿੱਥੇ ਦੇਖੋ ਲੋਕ ਗੱਡੀਆਂ ਮੋਟਰਸਾਈਕਲਾਂ 'ਤੇ ਚੌਵੀ ਘੰਟੇ ਹੀ ਤੁਰੇ ਰਹਿੰਦੇ ਨੇ ਕੋਈ ਤੁਰਕੇ ਨਹੀਂ ਜਾਂਦਾ ਕਿਉਂਕਿ ਸ਼ਹਿਰ 'ਚ ਦੂਰ ਹੀ ਬਹੁਤ ਹੁੰਦਾ ਹੈ ਘਰ ਤੋਂ ਇੰਨਾ ਦੂਰ ਹੁੰਦਾ ਬਜ਼ਾਰ ਵੀ ਲੋਕਾਂ ਨੂੰ ਮੋਟਰਸਾਈਕਲ ਸਕੂਟਰ 'ਤੇ ਹੀ ਜਾਣਾ ਪੈਂਦਾ ਅਤੇ ਜੇ ਦੇਖੀਏ ਪਿੰਡਾਂ 'ਚ ਪਿੰਡਾਂ 'ਚ ਲੋਕ ਤੁਰੇ ਫਿਰਦੇ ਰਹਿੰਦੇ ਨੇ ਸਾਰਾ ਦਿਨ ਆਪਣਾ ਘਰ ਦਾ ਕੰਮ ਵੀ ਨਿਬੇੜਦੇ ਨੇ ਜਾਂਦੇ ਜਾਂਦੇ ਸਬਜ਼ੀ ਭਾਜੀ ਵੀ ਲਿਆਉਂਦੇ ਆ ਇਸ ਲਈ ਪਿੰਡ ਨੂੰ ਅਸੀਂ ਤਰਜੀਹ ਦੇਵਾਂਗੇ ਕਿਉਂਕਿ ਪਿੰਡ ਸਾਡੇ ਲਈ ਵਧੀਆ ਗਾ ਉੱਥੇ ਦਾ ਵਾਤਾਵਰਨ ਵਧੀਆ ਗਾ ਸਾਡੇ ਬੱਚਿਆਂ ਲਈ ਵਧੀਆ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਦਾ ਪਤਾ ਲੱਗਦਾ ਵੀ ਇੱਥੋਂ ਦਾ ਕੀ ਮਹੌਲ ਸੀਗਾ